ਮੈਨੂੰ ਬਚਪਨ ਤੋਂ ਹੀ ਬਾਈਕ ਰਾਈਡਿੰਗ ਦਾ ਬਹੁਤ ਸ਼ੌਂਕ ਹੈ ਬਾਈਕ ਰਾਈਡ ਚਾਹੇ ਇਕੱਲੇ ਕਰਾਂ ਚਾਹੇ ਆਪਣੇ ਗਰੁੱਪ ਦੇ ਸਾਥੀਆਂ ਦੇ ਨਾਲ ਮੈਂ ਬਾਈਕ ਰਾਈਡਿੰਗ ਨੂੰ ਬਹੁਤ ਇੰਜੋਏ ਕਰਦਾ ਹਾਂ ਇਕੱਲੇ ਬਾਈਕਿੰਗ ਦੇ ਕਰਨ ਦੇ ਆਪਣੇ ਫਾਇਦੇ ਹਨ ਅਤੇ ਗਰੁੱਪ ਨਾਲ ਰਾਈਡ ਕਰਨ ਦੇ ਆਪਣੇ ਫਾਇਦੇ ਹਨ ਇਕੱਲੇ ਬਾਈਕਿੰਗ ਦੇ ਵਿੱਚ ਇਹ ਹੈ ਕਿ ਸਾਨੂੰ ਕਿਸੇ ਦੀ ਵੇਟ ਕਰਨੀ ਨਹੀਂ ਪੈਂਦੀ ਆਪਣੇ ਬਜਟ ਦੇ ਅਕੋਡਿੰਗਲੀ ਆਪਾਂ ਖਾ ਪੀ ਸਕਦੇ ਹਾਂ ਸਾਨੂੰ ਕਿਸੇ 'ਤੇ ਡਿਪੈਂਡ ਹੋਣ ਦੀ ਜ਼ਰੂਰਤ ਨਹੀਂ ਹੈ ਅਗਰ ਆਪਾਂ ਕੋਈ ਡਿਸੀਜ਼ਨ ਲੈਣਾ ਹੈ ਤਾਂ ਆਪਾਂ ਆਪਣੀ ਦਿਮਾਗ ਨਾਲ ਕੋਈ ਵੀ ਡਿਸੀਜ਼ਨ ਲੈ ਸਕਦੇ ਹਾਂ ਸਾਨੂੰ ਕਿਸੇ 'ਤੇ ਡਿਪੈਂਡ ਹੋਣਾ ਨਹੀਂ ਪੈਂਦਾ ਜਿਹਦੇ ਨਾਲ ਕਿ ਟਾਈਮ ਵੀ ਸੇਵ ਹੁੰਦਾ ਹੈ ਅਤੇ ਅਸੀਂ ਬੜੇ ਰਿਲੈਕਸ ਹੋ ਕੇ ਚੀਜ਼ਾਂ ਨੂੰ ਇੰਜੋਏ ਕਰ ਪਾਉਂਦੇ ਹਾਂ ਗਰੁੱਪ ਨਾਲ ਰਾਈਡ ਕਰਨ ਦਾ ਇਹ ਫਾਇਦਾ ਹੈ ਕਿ ਸੜਕ 'ਤੇ ਹਾਦਸੇ ਤਾਂ ਹੁੰਦੇ ਹੀ ਰਹਿੰਦੇ ਹਨ ਚਾਹੇ ਇਕੱਲੇ ਕਰੋ ਚਾਹੇ ਸਾਥੀਆਂ ਦੇ ਨਾਲ ਕਰੋ ਇਕੱਲੇ ਬੰਦੇ ਨੂੰ ਇਹ ਡਰ ਹੁੰਦਾ ਹੈ ਕਿ ਬਾਈ ਚਾਂਸ ਅਗਰ ਮੇਰੇ ਮੈਂ ਡਿੱਗ ਗਿਆ ਅਤੇ ਮੇਰੇ ਸੱਟ ਲੱਗ ਗਈ ਤਾਂ ਮੈਨੂੰ ਕੌਣ ਸਾਂਭੇਗਾ ਅਗਰ ਆਪਾਂ ਗਰੁੱਪ ਨਾਲ ਰਾਈਡ ਕਰਦੇ ਹਾਂ ਅਤੇ ਉਹਨਾਂ ਕੋਲ ਕਿਸੇ ਨਾ ਕਿਸੇ ਕੋਲ ਫਸਟ ਏਡ ਹੁੰਦੀ ਹੈ ਉਹ ਇੱਕ ਦੂਜੇ ਦੀ ਕੇਅਰ ਕਰਦੇ ਹਨ ਜੇ ਸਪੋਜ ਕਰੋ ਕਿਸੇ ਕੋਈ ਡਿੱਗ ਗਿਆ ਅਤੇ ਉਸ ਵੇਲੇ ਉਠਾ ਕੇ ਉਹਨੂੰ ਬਹਾਣਗੇ ਉਹਨੂੰ ਫਸਟ ਏਡ ਦੇਣਗੇ ਉਹਦੀ ਕੇਅਰ ਕਰਨਗੇ ਅਤੇ ਉਹ ਬੰਦਾ ਸੇਫ ਫੀਲ ਕਰਦਾ ਹੈ ਅਤੇ ਕਿਸੇ ਵੇਲੇ ਆਪਾਂ ਰਾਤੀਂ ਲੇਟ ਹੋ ਜਾਂਦੇ ਹਾਂ ਆਪਣੀ ਡੈਸਟੀਨੇਸ਼ਨ 'ਤੇ ਪਹੁੰਚਣ 'ਤੇ ਤਾਂ ਆਪਣੇ ਸਾਥੀਆਂ ਨਾਲ ਸਾਨੂੰ ਸੇਫ ਫੀਲ ਹੁੰਦਾ ਹੈ ਕਿ ਕੋਈ ਨਾ ਅਸੀਂ ਕਾਫੀ ਜਣੇ ਇਕੱਠੇ ਟਰੈਵਲ ਕਰ ਰਹੇ ਹਾਂ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ ਸੋ ਬਾਈਕਿੰਗ ਇੱਕ ਬਹੁਤ ਵਧੀਆ ਚੀਜ਼ ਹੈ ਦੋਨਾਂ ਦੇ ਹੀ ਆਪੋ ਆਪਣੇ ਫਾਇਦੇ ਹਨ